ਹਾਂਜੀ ਅਸੀਂ ਸੋਸ਼ਲ ਮੀਡੀਆ 'ਤੇ ਵੀ ਦੇਖਦੇ ਰਹਿੰਦੇ ਹਾਂ ਨਿਊਜ਼ ਚੈਨਲਾਂ 'ਤੇ ਵੀ ਦੇਖਦੇ ਹਾਂ ਅਤੇ ਰੇਡੀਓ 'ਤੇ ਵੀ ਸੁਣਦੇ ਹਾਂ ਕਿ ਗ੍ਰਹਿਾਂ 'ਤੇ ਜੀਵਨ ਹੁੰਦਾ ਹੈ ਅਤੇ ਇਹਦੇ ਬਾਰੇ ਕਾਫੀ ਖੋਜ ਕਰ ਰਹੇ ਹਨ ਲੋਕ ਚੰਦਰਮਾ 'ਤੇ ਜਾ ਕੇ ਵੀ ਰਹਿ ਸਕਦੇ ਹਨ ਕਿਉਂਕਿ ਹੁਣ ਹਾਲ ਹੀ ਵਿੱਚ ਉੱਥੇ ਜਾ ਕੇ ਖੋਜ ਕੀਤੀ ਗਈ ਹੈ ਅਤੇ ਲੋਕ ਉੱਥੇ ਰਹਿਣ ਲਈ ਜਗ੍ਹਾ ਬਣਾ ਰਹੇ ਹਨ ਅਤੇ ਬਾਕੀ ਵੀ ਹੋਰ ਗ੍ਰਹਿਆਂ 'ਤੇ ਵੀ ਲੋਕ ਮਤਲਬ ਕਿ ਜਾਣ ਦੀ ਸਰਚ ਕਰ ਰਹੇ ਹਨ ਪਰ ਜੋ ਵੀ ਹੈ ਸਭ ਤੋਂ ਵੱਡਾ ਜੀਵਨ ਆਪਣਾ ਧਰਤੀ 'ਤੇ ਹੀ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਲੋਕ ਇੱਥੇ ਰਹਿਣਾ ਪਸੰਦ ਕਰਦੇ ਹਨ ਉਹ ਕੋਈ ਕੋਈ ਹੈ ਕੋਈ ਐਸਟਰੋਨੋਟ ਲਾ ਲਓ ਕੋਈ ਵਿਗਿਆਨੀ ਲਾ ਲਓ ਬਾਹਰਲੇ ਜੀਵ ਲਾ ਲਓ ਕਿ ਉਹ ਉੱਪਰਲਿਆਂ ਗ੍ਰਹਿਵਾਂ 'ਤੇ ਜਾ ਕੇ ਰਹਿਣਾ ਪਸੰਦ ਕਰਦੇ ਹਨ ਬਾਕੀ ਸਿਧਾਂਤ ਇੱਕ ਹੀ ਹੈ ਇੱਕ ਧਰਤੀ ਇੱਕ ਜੀਵਨ ਇੱਕ ਤਰ੍ਹਾਂ ਦੇ ਲੋਕ ਇਹ ਸਾਡਾ ਸਿਧਾਂਤ ਹੈ ਜੀ ਧੰਨਵਾਦ